ਸਾਡੇ ਆਲ਼ੇ ਦੁਆਲ਼ੇ ਦੇ ਘਰਾਂ ਦੇ ਵਿੱਚ ਦੇਖਿਆ ਜਾਂਦਾ ਹੈਗਾ ਕਿ ਮੱਛਰ ਬਹੁਤ ਅਲਾਰਬਾ ਵਗੈਰਾ ਉਹਨਾਂ ਦਾ ਅਸੀਂ ਬਹੁਤ ਰੋਕਥਾਮ ਕਰਦੇ ਹਾਂ ਅਸ ਗਲ਼ੀਆਂ ਨਾਲ਼ੀਆਂ ਨੂੰ ਸਾਫ ਰੱਖਦੇ ਹਾਂ ਘਰ ਦੇ ਵਿੱਚ ਵੀ ਜਗ੍ਹਾ ਰੱਖ ਕੇ ਅਤੇ ਸਫਾਈ ਦਾ ਜ਼ੋਰ ਰੱਖੀਦਾ ਹੈਗਾ ਅਤੇ ਆਪ ਅਸੀਂ ਬਹੁਤ ਸਫਾਈ ਕਰਨੀ ਪੈਂਦੀ ਹੈਗੀ ਹੈ ਕਿ ਆਪਣੀ ਕੋਈ ਦਿੱਕਤ ਨਾ ਆਵੇ ਮੱਛਰ ਨਾਲ਼ ਕਾਫੀ ਅਸੀਂ ਸਪਰੇਅ ਵਗੈਰਾ ਵੀ ਕਰਦੇ ਹਾਂ ਗੰਦੀਆਂ ਜਗ੍ਹਾ 'ਤੇ ਨਾਲ਼ਿਆਂ ਦੇ ਲਾਗੇ ਸ਼ਾਗੇ ਅਤੇ ਘਾਹ ਫੂਸ ਬਹੁਤ ਜੰਮਦਾ ਹੈ ਉਹਨੂੰ ਵੀ ਪੱਟ ਕੇ ਸਾਫ਼ ਸਫ਼ਾਈ ਕੀਤੀ ਜਾਂਦੀ ਹੈਗੀ ਪਰ ਦੇਖੀ ਦਾ ਵੀ ਕਾਫੀ ਅਸੀਂ ਉਹ ਕਰਾਂਗੇ ਸਹੂਲਤ ਕਰਦੇ ਹਾਂ ਹੋਰਨਾਂ ਵੀ ਦੱਸੀਦਾ ਸਹੂਲਤਾਂ ਦਈਦੀਆਂ ਵੀ ਸਫਾਈ ਤੇ ਜ਼ੋਰ ਦੇ ਕੇ ਰੱਖੋ ਤੁਸੀਂ ਅ ਤਾਂ ਮੱਛਰ ਤੋਂ ਫਾਇਦਾ ਹੋ ਸਕੇ ਸਾਨੂੰ ਹੋਰ ਵੀ ਕਾਫੀ ਚੀਜ਼ਾਂ ਦੇਖੀ ਦੀਆਂ ਇੱਧਰ ਉਧਰ ਘੁੰਮ ਕੇ ਘਰ ਦੇ ਆਲ਼ੇ ਦੁਆਲ਼ੇ ਵੀ ਗੰਦ ਪਿਆ ਹੁੰਦਾ ਉਹਨੂੰ ਵੀ ਅਸੀਂ ਸਾਫ਼ ਕਰਕੇ ਰੱਖਦੇ ਹਾਂ ਅਤੇ ਕਾਫੀ ਕੋਈ ਇੰਨਾ ਬਸ